ਮੈਂ ਜਸਪ੍ਰੀਤ ਕੌਰ ਪਿੰਡ ਹੰਡਿਆਇਆ ਜ਼ਿਲ੍ਹਾ ਬਰਨਾਲਾ ਦੀ ਵਸਨੀਕ ਹਾਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਲੋਕ ਕਿੱਤੇ ਪੁਰਾਤਨ ਕਾਲ ਤੋਂ ਹੀ ਮਨੁੱਖੀ ਜੀਵਨ ਜਾਂਚ ਦਾ ਅੰਗ ਰਹੇ ਹਨ ਇਹਨਾਂ ਦੇ ਵਿਕਾਸ ਕਾਰਨ ਹੀ ਸਮਾਜ ਦਾ ਵਿਕਾਸ ਹੋਇਆ ਹੈ ਮਨੁੱਖ ਜੰਗਲਾਂ ਤੋਂ ਚੋਪੜੀਆਂ ਨੂੰ ਛੱਡ ਕੇ ਪੱਕੇ ਘਰਾਂ ਪਿੰਡਾਂ ਅਤੇ ਨਗਰਾਂ ਦਾ ਨਿਰਮਾਣ ਕਰਨ ਲੱਗਾ ਨਾਲ ਨਾਲ ਕੰਮਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਇਹਨਾਂ ਦੀ ਵੰਡ ਦੀ ਲੋੜ ਪਈ ਇਹਨਾਂ ਨੂੰ ਜਦੋਂ ਵੰਡ ਕਰਨ ਦੀ ਲੋੜ ਪਈ ਤਾਂ ਵੱਖ ਵੱਖ ਕੰਮਾਂ ਨੂੰ ਸੁਚੱਜੇ ਢੰਗਾਂ ਨਾਲ ਸਹੀ ਤਰੀਕਿਆਂ ਨਾਲ ਕਈ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਜਿਵੇਂ ਲੋਹੇ ਦਾ ਕੰਮ ਕਰਨ ਵਾਲੇ ਲੁਹਾਰ ਲੱਕੜੀ ਦਾ ਕੰਮ ਕਰਨ ਵਾਲੇ ਨੂੰ ਤਰਖਾਣ ਅਤੇ ਭਾਂਡਿਆਂ ਦਾ ਕੰਮ ਕਰਨ ਵਾਲੇ ਨੂੰ ਘੁਮਿਆਰ ਕਿਹਾ ਜਾਣ ਲੱਗਾ ਇਸ ਤੋਂ ਵਾਵ ਇਸ ਤੋਂ ਇਲਾਵਾ ਕਿਸਾਨਾਂ ਦੇ ਆਪਣੇ ਕਿੱਤੇ ਖੇਤੀਬਾੜੀ ਫ਼ਸਲ ਬੀਜਣਾ ਫ਼ਸਲ ਉਗਾਉਣਾ ਆਦਿ ਕਿੱਤੇ ਆਦਿ ਸ਼ਾਮਲ ਹੋਏ ਸੰਸਕ੍ਰਿਤ ਵਿੱਚ ਹੱਥ ਨੂੰ ਕਰ ਕਿਹਾ ਜਾਂਦਾ ਹੈ ਹੱਥ ਨਾਲ ਕਿਤੇ ਕੰਮ ਨੂੰ ਕਾਰ ਕਰਨੀ ਕਿਹਾ ਜਾਂਦਾ ਹੈ ਕਿੱਤਾ ਉਸ ਨੂੰ ਕਿਹਾ ਜਾਂਦਾ ਹੈ ਜਿਸ ਕੰਮ ਤੋਂ ਕਿਸੇ ਕਿਰਤ ਦਾ ਨਿਰਮਾਣ ਹੁੰਦਾ ਹੋਵੇ ਕਿਰਤ ਇਸ ਤੋਂ ਇਲਾਵਾ ਨਵੇਂ ਕਿੱਤੇ ਵੀ ਸ਼ਾਮਲ ਹੋਏ ਜਿੱਦਾਂ ਕਿ ਹੋਟਲਾਂ ਮੌਲਾਂ ਅਤੇ ਕਈ ਤਰ੍ਹਾਂ ਦੇ ਹੋਰ ਵਿਕਸਿਤ ਪੰਜਾਬ ਵਿੱਚ ਨਵੇਂ ਕਿੱਤੇ ਸ਼ਾਮਲ ਕਿਤ ਹੋਏ ਜਿਸ ਨਾਲ ਪੰਜਾਬ ਵਿੱਚ ਰਵਾਇਤੀ ਕਿੱਤਿਆਂ ਦੀ ਕਾਫੀ ਚਰਚਾ ਹੋਈ ਇਸ ਨਾਲ ਆਰਥਿਕ ਅਤੇ ਤਕਨੀਕੀ ਤਬਦੀਲੀਆਂ ਦੇ ਜਵਾਬ ਵਿੱਚ ਇਹ ਕਿੱਤੇ ਸਮੇਂ ਦੇ ਨਾਲ ਨਾਲ ਵਿਕਸਿਤ ਹੋਏ ਜਿਸ ਨਾਲ ਪੰਜਾਬ ਵਿੱਚ ਵੀ ਕਾਫੀ ਤਬ ਤਬਦੀਲੀ ਲੋਕ ਇੱਥੇ ਪੁਰਾਤਨ ਕਾਲ ਤੋਂ ਹੀ ਮਨੁੱਖੀ ਜੀਵਨ ਦਾ ਜਾਂਚ ਦਾ ਅੰਗ ਰਹੇ ਹਨ ਮਨੁੱਖ ਜੰਗਲਾਂ ਝੋਪੜੇ ਦੇ ਨਵੇਂ ਕਿੱਤੇ ਅਤੇ ਨਵੇਂ ਨਗਰਾਂ ਦਾ ਨਿਰਮਾਣ ਕਰਨ ਲੱਗਾ ਉਸ ਨੇ ਆਪਣੇ ਨਗਰ ਬਣਾਉਣੇ ਸ਼ੁਰੂ ਕੀਤੇ ਲੋਕ ਕਿੱਤਿਆਂ ਦਾ ਰਵਾਇਤੀ ਕਿੱਤਿਆਂ ਦਾ ਮਨੁੱਖੀ ਜੀਵਨ 'ਤੇ ਬਹੁਤ ਅਸਰ ਪਿਆ ਹੈ